ਹੈਲੋ ਹਾਂਜੀ ਬਰੋਡਬੈਂਡ ਦਾ ਹੈਲਪਲਾਈਨ ਨੰਬਰ ਹੈ ਜੀ ਸਰ ਅਸੀਂ ਨਾ ਆਪਣਾ ਸ਼ਹਿਰ ਬਦਲ ਕੇ ਹੰਡਿਆਇਆ ਤੋਂ ਹੁਣ ਅਸੀਂ ਬਰਨਾਲਾ ਵਿਖੇ ਸ਼ਿਫਟ ਕਰ ਲਿਆ ਅਤੇ ਉੱਥੇ ਵੀ ਸਾਡੇ ਕੋਲ ਤੁਹਾਡਾ ਕਨੈਕਸ਼ਨ ਹੀ ਸੀਗਾ ਬਰੋਡਬੈਂਡ ਦਾ ਵਧੀਆ ਚੱਲਦਾ ਸੀ ਹੁਣ ਅਸੀਂ ਬਰਨਾਲੇ ਆਪਣੀ ਰਿਹਾਇਸ਼ ਕਰ ਲਈ ਹੈ ਪੱਕੀ ਜੀ ਅਤੇ ਇੱਥੇ ਵੀ ਅਸੀਂ ਚਾਹੁੰਦੇ ਹਾਂ ਵੀ ਬਰੋਡਵਿੰਡ ਦਾ ਕਨੈਕਸ਼ਨ ਹੀ ਲਿੱਤਾ ਜਾਵੇ ਅਤੇ ਇਹਦੀ ਸਪੀਡ ਵਗੈਰਾ ਵਧੀਆ ਹੁੰਦੀ ਹੈ ਤੇ ਤੁਸੀਂ ਲਾ ਦਿਉਂਗੇ ਇੱਥੇ ਆ ਕੇ ਬਰੋਡਬੈਂਡ ਅਸੀਂ ਜੀ ਹੰਡਿਆਇਆ ਰੋਡ ਦੇ ਉੱਤੇ ਹੀ ਰਹਿੰਦੇ ਹਾਂ ਅਤੇ ਉੱਥੇ ਇੱਕ ਕਲੋਨੀ ਬਣੀ ਹੈ ਜੈ ਬਾਟਿਕਾ ਉਹ ਕਲੋਨੀ ਦੇ ਵਿੱਚ ਆਪਣਾ ਚੌਥਾ ਮਕਾਨ ਹੀ ਹੈ ਜੀ ਕੋਠੀ ਨੰਬਰ ਇੱਕ ਸੌ ਛੇ ਹੈ ਉਹਦੇ ਵਿੱਚ ਤੁਸੀਂ ਇਹ ਬਰੋਡਬੈਡ ਦਾ ਕਨੈਕਸ਼ਨ ਲਗਾ ਦਿਉਂਗੇ ਤਾਂ ਬੜੀ ਮਿਹਰਬਾਨੀ ਹੋਵੇਗੀ ਬੀ ਐਸ ਐਨ ਐਲ ਵਾਲਾ ਹਾਂਜੀ ਹਾਂ ਬੀ ਐਸ ਐਨ ਐਲ ਦਾ ਸਾਨੂੰ ਵਧੀਆ ਲੱਗਦਾ ਕਿਉਂਕਿ ਸਪੀਡ ਵੀ ਵਧੀਆ ਹੁੰਦੀ ਐ ਇਹਦੀ ਅਤੇ ਰੇਟ ਵੀ ਘੱਟ ਹੁੰਦਾ ਅਤੇ ਇਹਦੇ 'ਚ ਕੋਈ ਦਿੱਕਤ ਵੀ ਨਹੀਂ ਆਉਂਦੀ ਰਿਪੇਅਰ ਵਗੈਰਾ ਟਾਈਮ ਨਾਲ ਹੋ ਜਾਂਦੀ ਹੈ ਤਾਂ ਸਾਨੂੰ ਤੁਸੀਂ ਬਰੋਡਬੈਂਡ ਦਾ ਕਨੈਕਸ਼ਨ ਲਗਾ ਕੇ ਦਿਓ ਜੀ ਜ਼ਰੂਰ ਜੇ ਤੁਸੀਂ ਜਲਦੀ ਲਗਾ ਦਿਓ ਤਾਂ ਬਹੁਤ ਵਧੀਆ ਕਿਉਂਕਿ ਬੱਚਿਆਂ ਨੇ ਸਟਡੀ ਵਗੈਰਾ ਕਰਨੀ ਹੁੰਦੀ ਹੈ ਅਤੇ ਇੰਟਰਨੈਟ ਜ਼ਰੂਰੀ ਹੈ ਮੈਂ ਵੀ ਆਪਣਾ ਆਫਿਸ ਦਾ ਕੰਮ ਵਗੈਰਾ ਘਰ ਤੋਂ ਕਰਨਾ ਹੁੰਦਾ ਅਤੇ ਜੇ ਤੁਸੀਂ ਜਲਦੀ ਦੋ ਚਾਰ ਦਿਨਾਂ ਦੇ ਵਿਚ ਹੀ ਇਹ ਲਗਾ ਦਿਓ ਤਾਂ ਐਡਵਾਂਸ ਪੇਮੈਂਟ ਤੁਹਾਨੂੰ ਕਰ ਦਿਆਂਗੇ ਜਿੱਥੇ ਕਹੋਗੇ ਜਿਹੜਾ ਜਾਂ ਨੰਬਰ ਭੇਜ ਦਿਓ ਕੋਈ ਗੂਗਲ ਪੇ ਵਗੈਰਾ ਕਰਕੇ ਅਸੀਂ ਐਡਵਾਂਸ ਕਰ ਪੇਮੈਂਟ ਕਰ ਦਿਆਂਗੇ ਅਤੇ ਤੁਸੀਂ ਇਹ ਸਾਨੂੰ ਦੋ ਚਾਰ ਦਿਨਾਂ ਦੇ ਵਿੱਚ ਜ਼ਰੂਰ ਜਲਦੀ ਤੋਂ ਜਲਦੀ ਲਗਾ ਕੇ ਦਿਓ ਜੀ ਬਾਕੀ ਮੈਂ ਜਿਹੜਾ ਆਪਣਾ ਐਡਰੈਸ ਹੈ ਜੀ ਉਹ ਤੁਹਾਡੇ ਨੰਬਰ ਤੇ ਮੈਸੇਜ ਕਰ ਦਿੰਦਾ ਉਹਦਾ ਆਪਣਾ ਐਡਰੈਸ ਲਿਖ ਕੇ ਤੁਹਾਨੂੰ ਭੇਜ ਦਿੰਦਾ ਤਾਂ ਉਸ ਐਡਰਸ 'ਤੇ ਤੁਸੀਂ ਮੈਨੂੰ ਕਾਲ ਕਰ ਲਿਓ ਮੈਂ ਫੋਨ ਨੰਬਰ ਵੀ ਤੁਹਾਡੇ ਕੋਲ ਆ ਗਿਆ ਮੇਰਾ ਅਤੇ ਆਪਣੇ ਇੱਥੋਂ ਦੇ ਬਰਨਾਲੇ ਦੇ ਚਾਰਜਜ ਵਗੈਰਾ ਜਿਹੜੇ ਨੇ ਕੋਈ ਖਰਚਾ ਵਗੈਰਾ ਉਹ ਵੀ ਮੈਨੂੰ ਦੱਸ ਦਿਓ ਜੀ ਤਾਂ ਕਿ ਮੈਂ ਉਸ ਹਿਸਾਬ ਨਾਲ ਆਪਣਾ ਪੇਮੈਂਟ ਤਿਆਰ ਰੱਖ ਸਕਾਂ ਅਤੇ ਜਲਦੀ ਤੋਂ ਜਲਦੀ ਲਗਾਉਣ ਦੀ ਕਿਰਪਾ ਕਰੀ ਜਾਵੇ ਤਾਂ ਕਿ ਮ ਸਾਡਾ ਕੰਮ ਸਾਰੇ ਨਿਰਵਿਘਨ ਹੋ ਸਕਣ ਬੱਚੇ ਦੀ ਪੜ੍ਹਾਈ ਲਗਾਤਾਰ ਚੱਲ ਸਕੇ ਕਿਉਂਕਿ ਅੱਜ ਕੱਲ੍ਹ ਤਾਂ ਇਹ ਬਹੁਤ ਜ਼ਰੂਰੀ ਇਹਦੇ ਬਿਨਾਂ ਸਰਦਾ ਹੀ ਨਹੀਂ ਜੀ ਅਤੇ ਪਿੰਡ ਵੀ ਸਾਡਾ ਵਧੀਆ ਚੱਲੀ ਜਾਂਦਾ ਸੀ ਚਲੋ ਹੁਣ ਸ਼ਹਿਰ 'ਚ ਆ ਗਏ ਹੁਣ ਇੱਥੇ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਇਸ ਲਈ ਜਲਦੀ ਤੋਂ ਜਲਦੀ ਸਾਡੇ ਕਨੈਕਸ਼ਨ ਲਗਾ ਦਿਓ ਜੀ ਸਰਦਾ ਨਹੀਂ ਇਹਦੇ ਬਿਨਾਂ ਤਾਂ